ਕਿਤਾਬਾਂ ਪੜ੍ਹਨਾ ਮੇਰਾ ਜ਼ਿੰਦਗੀ ਦਾ ਪਹਿਲਾ ਸ਼ੌਕ ਹੈ ਅੱਜ ਕੱਲ੍ਹ ਦੇ ਕਾਹਲ ਦੇ ਸਮੇਂ ਦੇ ਵਿੱਚ ਮੈਂ ਈ ਬੁੱਕਸ ਪੜ੍ਹਨੀਆਂ ਜ਼ਿਆਦਾ ਪ੍ਰੈਫਰ ਕਰਦਾ ਕਿਉਂਕਿ ਸਫ਼ਰ ਦੇ ਦੌਰਾਨ ਵੀ ਇਹ ਬੜੀਆਂ ਆਨੰਦਮਈ ਰਹਿੰਦੀਆਂ ਨੇ ਅਰਾਮਦਾਇਕ ਰਹਿੰਦੀਆਂ ਨੇ ਇਸੇ ਇਸ ਵਾਰ ਵੀ ਮੈਂ ਔਨਲਾਈਨ ਕਿਤਾਬ ਔਡਰ ਕੀਤੀ ਸੀ ਪ੍ਰੋਫੈਸਰ ਪੂਰਨ ਸਿੰਘ ਦੀ ਲਿਖਤ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ ਇਸ ਬੁੱਕ ਦੇ ਬਾਰੇ ਮੈਨੂੰ ਮੇਰੇ ਦੋਸਤ ਨੇ ਹੀ ਸੁੁਜੈਸਟ ਕੀਤਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਸਿੱਖ ਬੁੱਕ ਕਲੱਬ ਡੋਟ ਕੌਮ ਔਨਲਾਇਨ ਸਾਈਟ 'ਤੇ ਗਿਆ ਅਤੇ ਉੱਥੇ ਬੁੱਕ ਦਾ ਨੇਮ ਭਰ ਕੇ ਬੁੱਕ ਸਰਚ ਕੀਤੀ ਜਦੋਂ ਬੁੱਕ ਸਾਹਮਣੇ ਆਈ ਤਾਂ ਉਹਦੇ ਚਾਰ ਪੰਜ ਪੇਜ ਡੈਮੋ ਰੀਡਿੰਗ ਵਾਸਤੇ ਦਿੱਤੇ ਹੋਏ ਸੀ ਉਹਨਾਂ ਨੇ ਉਹ ਕਿਤਾਬ ਦੇ ਮੈਂ ਚਾਰ ਪੰਜ ਪੇਜ ਪੜ੍ਹੇ ਅਤੇ ਕਿਤਾਬ ਪੜ੍ਹ ਕੇ ਮੈਨੂੰ ਬੜਾ ਵਧੀਆ ਲੱਗਿਆ ਉਹਦੀ ਫੋਰਮੈਟਿੰਗ ਕਿਤਾਬ ਦੇ ਅੱਖਰਾਂ ਦੇ ਸਟਾਈਲ ਵਗੈਰਾ ਸਾਰੇ ਬੜੇ ਵਧੀਆ ਸੀ ਅਤੇ ਨਾਲ ਦੀ ਨਾਲ ਹੀ ਕਿਤਾਬ ਦਾ ਪ੍ਰਈਜ਼ ਵੀ ਦੱਸਿਆ ਹੋਇਆ ਸੀ ਉਹਨਾਂ ਨੇ ਮੈਂ ਔਨਲਾਈਨ ਉਸੇ ਵਕਤ ਔਨਲਾਈਨ ਪੇਮੈਂਟ ਕੀਤੀ ਅਤੇ ਬੁੱਕ ਨੂੰ ਡਾਊਨਲੋਡ ਕੀਤਾ ਡਾਊਨਲੋਡ ਕਰਕੇ ਜਦੋਂ ਪੂਰੀ ਕਿਤਾਬ ਪੜ੍ਹੀ ਪੜ੍ਹ ਕੇ ਮੈਨੂੰ ਬੜਾ ਆਨੰਦ ਆਇਆ ਅਤੇ ਕਿਤਾਬ ਦੀ ਫੋਰਮੈਟੀਮ ਵਗੈਰਾ ਸਾਰੇ ਪਹਿਲੀ ਜਿਲਦ ਦੇ ਪੇਜ ਤੋਂ ਲੈ ਕੇ ਆਖਰੀ ਪੇਜ ਤੱਕ ਕਿਤਾਬ ਬੜੀ ਵਧੀਆ ਰਹੀ ਅਤੇ ਮੈਂ ਤੁਹਾਨੂੰ ਵੀ ਇਹ ਸੁਜੈਸਟ ਕਰਾਂਗਾ ਕਿ ਜਦੋਂ ਵੀ ਤੁਸੀ ਔਨਲਾਈਨ ਕਿਤਾਬ ਪੜ੍ਹਨੀ ਹੈ ਤਾਂ ਤੁਸੀਂ ਇਸੇ ਸਾਇਟ 'ਤੇ ਵਿਜ਼ਿਟ ਕਰੋ ਅਤੇ ਕਿਤਾਬ ਪੜ੍ਹੋ